ਪ੍ਰਵੇਸ਼ ਦੁਆਰ ਅਤੇ ਗੋਬਰ ਨੂੰ ਹਿੰਦੂ ਲੋਕ ਪਵਿੱਤਰ ਸਮਝਦੇ ਹਨ ਇਸ ਨੂੰ ਪਾਣੀ ਵਿੱਚ ਮਿਲਾ ਕੇ ਪ੍ਰਵੇਸ਼ ਦੁਆਰ ਵਿੱਚ ਛਿੜਕਣ ਨਾਲ ਪਵਿੱਤਰ ਸਮਝਿਆ ਜਾਂਦਾ ਹੈ ਕ ਕਈ ਲੋਕ ਇਸ ਤਰ੍ਹਾਂ ਗੋਬਰ ਦਾ ਪੋਚਾ ਵੀ ਲਗਾਉਂਦੇ ਹਨ ਘਰ ਵਿਚ ਗੋਬਰ ਦਾ ਪੋਚਾ ਚੌਂਕੇ ਵਿੱਚ ਲਗਾਉਣ ਨਾਲ ਸੁੱਚਾ ਮੰਨਦੇ ਹਨ ਜੇ ਸੈਂਸ ਦੀ ਨਜ਼ਰ ਨਾਲ ਦੇਖੀਏ ਤਾਂ ਪਾਣੀ ਨਾਲ ਸਫ਼ਾਈ ਕਰ ਕੇ ਵਿੱਚ ਫਰਨੈਲ ਮਿਲਾ ਕੇ ਕੀੜੇ ਵੀ ਨਹੀਂ ਆਉਂਦੇ ਮੱਖੀ ਮੱਛਰ ਵੀ ਨਹੀਂ ਆਉਂਦੇ